ਪੰਜਾਬ ਦੇ ਵਿੱਚ ਜੈਂਡਰ ਇਕੁਲਿਟੀ ਦੇ ਲਈ ਕਾਫ਼ੀ ਸਾਰੇ ਐਜੂਕੇਸ਼ਨ ਪੋਲਿਸਿਸ ਕੱਢੀਆਂ ਨੇ ਜਿੱਦਾਂ ਕਿ ਹਰ ਇੱਕ ਬੱਚਿਆਂ ਨੂੰ ਸਕੂਲ ਦੇ ਵਿੱਚ ਦੱਸਿਆ ਜਾਂਦਾ ਕਿ ਜੈਂਡਰ ਜਿਹੜੇ ਨੇ ਉਹ ਇੱਦਾਂ ਨਹੀਂ ਹੈ ਕਿ ਤੁਸੀਂ ਇਹ ਸਮਝਣਾ ਕਿ ਇਹ ਕੰਮ ਜਿਹੜਾ ਮੁੰਡਾ ਹੀ ਕਰੇਗਾ ਇਹ ਕੰਮ ਕੁੜੀ ਓਹ ਹੀ ਕਰੇਗੀ ਇੱਦਾਂ ਦਾ ਕੁਛ ਨਹੀਂ ਹੈ ਇਕੁਅਲ ਓਪੋਰਚੁਨਿਟੀਜ ਦਿੱਤੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਸਾਰਾ ਕੁਛ ਸਿਖਾਇਆ ਜਾ ਰਿਹਾ ਔਰ ਜੈਂਡਰ ਗੈਪ ਜਿਹੜਾ ਐਜੂਕੇਸ਼ਨ ਦਾ ਉਹ ਕਵਰ ਅਪ ਕੀਤਾ ਜਾ ਰਿਹਾ ਕਿ ਸਿਰਫ ਇਹ ਨਹੀਂ ਹੈ ਕਿ ਸਿਰਫ ਕੁੜੀਆਂ ਮੁੰਡਿਆਂ ਨੂੰ ਹੀ ਪੜ੍ਹਾਇਆ ਜਾਵੇਗਾ ਕੁੜੀਆਂ ਨੂੰ ਨਹੀਂ ਪੜ੍ਹਾਇਆ ਜਾਵੇਗਾ ਉਹ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿ ਜੇ ਤੁਸੀਂ ਅੱਜ ਕੱਲ੍ਹ ਕੁੜੀਆਂ ਨੂੰ ਵੀ ਪੜ੍ਹਾਉਂਦੇ ਹੋ ਤਾਂ ਜਿਹੜਾ ਹੈਗਾ ਕੁੜੀਆਂ ਵੀ ਤੁਹਾਡੇ ਵੰਸ਼ ਨੂੰ ਅੱਗੇ ਲੈ ਕੇ ਜਾ ਸਕਦੀਆਂ ਤੁਹਾਨੂੰ ਤਰੱਕੀਆਂ ਦੇ ਰਾਹਾਂ 'ਤੇ ਲੈ ਕੇ ਜਾ ਸਕਦੀਆਂ ਕੁੜੀਆਂ ਅੱਜ ਕੱਲ੍ਹ ਹਰ ਖੇਤਰ 'ਚ ਕੰਮ ਕਰ ਰਹੀਆਂ ਨੇ ਤਾਂ ਉਹ ਚੀਜ਼ ਜਿਹੜੀ ਹੈਗੀ ਆ ਉਹਦੇ ਉੱਤੇ ਘਰਦਿਆਂ ਨੂੰ ਬੱਚਿਆਂ ਦੇ ਐਜੂਕੇਟ ਕੀਤਾ ਜਾ ਰਿਹਾ ਕਿ ਆਪਣੇ ਬੱਚਿਆਂ ਨੂੰ ਪੜਾਓ ਮਜ਼ਦੂਰੀ ਦੇ ਵਿੱਚ ਨਾ ਲਗਾਓ ਉਹਨਾਂ ਨੂੰ ਪੜ੍ਹਾਉਂਗੇ ਤਾਂ ਤੁਹਾਡੇ ਜਿਹੜੇ ਨੇ ਉਹ ਸਾਰੇ ਕੰਮ ਪੂਰੇ ਹੋਣਗੇ ਤੁਹਾਡੀਆਂ ਜੂਨਾਂ ਸੁਧਰ ਜਾਣਗੀਆਂ ਤਾਂ ਇਹ ਚੀਜ਼ ਜਿੰਨੀ ਕੀਤੀ ਜਾਵੇਗੀ ਬਾਕੀ ਬੱਚਿਆਂ ਨੂੰ ਅਤੇ ਕੁੜੀਆਂ ਥੋੜ੍ਹੀਆਂ ਸੈਂਸਿਟਿਵ ਹੁੰਦੀਆਂ ਨੇ ਤਾਂ ਉਸ ਅਕੋਡਿੰਗਲੀ ਮੁੰਡੇ ਉਹਨਾਂ ਦੇ ਨਾਲ ਕਿੱਦਾਂ ਡੀਲ ਕਰਨ ਤਾਂ ਜੇ ਮੁੰਡੇ ਸੈਂਸਿਟਿਵ ਨੇ ਤਾਂ ਕੁੜੀਆਂ ਉਹਨਾਂ ਦੇ ਨਾਲ ਕਿੱਦਾਂ ਡੀਲ ਕਰਨ ਤੋ ਹਰ ਚੀਜ਼ ਜਿਹੜੀ ਉਹਨੂੰ ਪ੍ਰੋਪਰਲੀ ਐਜੂਕੇਟ ਕੀਤੀ ਜਾ ਰਹੀ ਹੈ